ਪੰਜਾਬੀ ਭਾਸ਼ਾ ਜੋ ਹੈ ਉਹ ਸਾਡੀ ਮਾਤ ਭਾਸ਼ਾ ਹੈ ਜਿਸ ਵਿੱਚ ਅਗਰ ਅਸੀਂ ਕਿਸੇ ਨਾਲ ਵੀ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਪੰਜਾਬੀ ਵਿੱਚ ਬੋਲਣਾ ਬਹੁਤ ਹੀ ਅੱਛਾ ਲੱਗਦਾ ਏ ਉਹਦੇ ਵਿੱਚ ਕਿਉਂਕਿ ਆਦਰ ਭਾਵਨਾ ਜੋ ਹੈ ਸਤਿਕਾਰ ਭਾਵਨਾ ਪ੍ਰਗਟ ਹੁੰਦੀ ਹੈ ਅਤੇ ਇਹ ਬਹੁਤ ਹੀ ਮਤਲਬ ਦਿਲ 'ਚ ਲੱਗਦੀ ਹੈ ਜਿਸ ਤਰ੍ਹਾਂ ਮੈਂ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਦੱਸਦੀ ਹਾਂ ਕਿ ਮੈਂ ਆਪਣੀ ਕਿਸੇ ਫਰੈਂਡ ਦੀ ਮੈਰਿਜ 'ਤੇ ਉਨ੍ਹਾਂ ਦੇ ਘਰ ਗਈ ਹੋਈ ਸੀ ਕਿਸੇ ਹੋਰ ਸਟੇਟ ਦੇ ਵਿੱਚ ਜਦੋਂ ਮੈਂ ਉੱਥੋਂ ਆਪਣੀ ਮੰਮੀ ਨਾਲ ਗੱਲ ਕਰ ਰਹੀ ਸੀਗੀ ਅਤੇ ਉਨ੍ਹਾਂ ਉੱਥੋਂ ਦੇ ਲੋਕਾਂ ਨੇ ਅਤੇ ਮੇਰੀ ਫਰੈਂਡ ਨੇ ਜੋ ਹੈ ਸਾਡੀ ਵਾਰਤਾਲਾਪ ਸੁਣੀ ਸੀਗੀ ਅਤੇ ਉਨ੍ਹਾਂ ਨੂੰ ਇਹ ਮਤਲਬ ਕਿ ਜਿਹੜੀ ਸਾਡੀ ਗੱਲ ਹੈ ਉਹ ਸੁਣ ਕੇ ਬਹੁਤ ਹੀ ਅੱਛਾ ਲੱਗਿਆ ਉਨ੍ਹਾਂਂ ਨੂੰ ਬਹੁਤ ਹੀ ਸਾਡੀ ਪੰਜਾਬੀ ਭਾਸ਼ਾ ਹੈ ਜੋ ਪਸੰਦ ਆਈ ਉਨ੍ਹਾਂ ਉਨ੍ਹਾਂ ਨੇ ਮਤਲਬ ਮੈਨੂੰ ਕਿਹਾ ਕਿ ਸਾਨੂੰ ਵੀ ਇਹ ਭਾਸ਼ਾ ਸਿਖਾ ਕਿਉਂਕਿ ਇਹ ਬਹੁਤ ਹੀ ਪਿਆਰੀ ਅਤੇ ਸਤਿਕਾਰ ਭਾਵਨਾ ਵਾਲੀ ਭਾਸ਼ਾ ਲੱਗਦੀ ਹੈ ਇੰਟਰਟੇਨਮੈਂਟ ਦੇ ਤੌਰ 'ਤੇ ਵੀ ਅਗਰ ਦੇਖਿਆ ਜਾਏ ਅਗਰ ਕਿਸੇ ਵੀ ਸਟੇਟ ਦੇ ਵਿੱਚ ਦੇਖਿਆ ਜਾਏ ਅਤੇ ਜੋ ਜ਼ਿਆਦਾਤਰ ਜੋ ਹੈ ਪੰਜਾਬੀ ਗਾਣੇ ਹੀ ਚਲਾਏ ਜਾਂਦੇ ਹਨ ਕਿਉਂਕਿ ਉਹ ਜ਼ਿਆਦਾ ਮੰਨੋਰੰਜਨ ਲਾਇਕ ਲੱਗਦੇ ਹਨ ਥੈਂਕ ਯੂ